ਇਸ ਤਰ੍ਹਾਂ ਦੀਆਂ ਕਈ ਸਾਰੀਆਂ ਕਿਤਾਬਾਂ ਹਨ ਜਿਨ੍ਹਾਂ ਨੇ ਮੈਨੂੰ ਸੋਚਣ ਉਕਸਾਉਣ ਲਈ ਜਿਹੜਾ ਮਜਬੂਰ ਕੀਤਾ ਮੈਂ ਕਈ ਸਾਰੀ ਕਿਤਾਬਾਂ ਰੀਡ ਕਰਦੀ ਰਹਿੰਦੀ ਹਾਂ ਜਿਹਨਾਂ ਵਿੱਚੋਂ ਜਿਹੜੀਆਂ ਕਿ ਬਹੁਤ ਹੀ ਵਧੀਆ ਹਨ ਉਹਨਾਂ ਵਿੱਚੋਂ ਇੱਕ ਹੈ ਜੋ ਕਿ ਪੋਲੀਟਿਕਸ ਦੇ ਲਈ ਹੈ ਲਕਸ਼ਮੀ ਕਾਂਤ ਨੇਮ ਦੀ ਬੁੱਕ ਹੈ ਮੈਂ ਉਹਨੂੰ ਰੀਡ ਕੀਤਾ ਉਹਦੇ ਵਿੱਚ ਜਿਹੜੇ ਪੋਲੀਟਿਕਸ ਦੇ ਕੋਨਸੈਪਟ ਆ ਬਹੁਤ ਹੀ ਵਧੀਆ ਤਰੀਕੇ ਨਾਲ ਜਿਹੜੇ ਆ ਐਕਸਪਲੇਨ ਕੀਤੇ ਗਏ ਹੈ ਕੋਨਸਟੀਟਿਊਸ਼ਨਸ ਦੇ ਬਾਰੇ ਬਹੁਤ ਹੀ ਚੰਗੀ ਤਰ੍ਹਾਂ ਸਮਝਾਇਆ ਗਿਆ ਜਿਹਦੇ ਵਿੱਚ ਆਰਟੀਕਲਸ ਵਗੈਰਾ ਨੂੰ ਡਿਟੇਲ ਵਿੱਚ ਦੱਸਿਆ ਗਿਆ ਕਿ ਕਿੱਦਾਂ ਮਤਲਬ ਸਾਡੀ ਜਿਹੜੀ ਪੋਲਿਟਿਕਸ ਆ ਉਹਦੇ ਵਿੱਚ ਅੰਦਰ ਕੀ ਕੀ ਹੈ ਮੈਂ ਅੱਜ ਤੱਕ ਕਦੇ ਵੀ ਕਿਸੇ ਕਿਤਾਬ ਰੀਡਿੰਗ ਕਲੱਬ ਵਿੱਚ ਸ਼ਾਮਿਲ ਤਾਂ ਨਹੀਂ ਹੋਈ ਪਰ ਮੈਂ ਬਹੁਤ ਸਾਰੀਆਂ ਜਿਹੜੀਆਂ ਬੁੱਕਸ ਆ ਉਹ ਰੀਡ ਕੀਤੀਆਂ ਜਿੱਦਾਂ ਕਿ ਐੱਨ ਡੀ ਏ ਲਈ ਮੈਂ ਪਾਥ ਫਾਇਨਡਰ ਬੁੱਕ ਰੀਡ ਕੀਤੀ ਜਿਹਦੇ ਵਿੱਚ ਕਿ ਉਹਦੇ ਜਿਹੜੇ ਸਿਲੇਬਸ ਨੂੰ ਆ ਬਹੁਤ ਹੀ ਵਧੀਆ ਤਰੀਕੇ ਨਾਲ ਦੱਸਿਆ ਗਿਆ ਪੂਰਾ ਸਿਲੇਬਸ ਜਿਹੜਾ ਉਹ ਕਵਰ ਕੀਤਾ ਗਿਆ ਮੈਥਸ ਇੰਗਲਿਸ਼ ਦੇ ਸੈਸ਼ਨ ਜਿਹੜੇ ਆ ਅਲੱਗ ਅਲੱਗ ਉਹਨਾਂ ਦੀ ਉਹਨਾਂ ਦੇ ਰੀਲੇਟਡ ਜਿਹੜੇ ਕੋਸ਼ਚਨਸ ਵੀ ਨਾਲ ਪ੍ਰੋਵਾਈਡ ਕੀਤੇ ਗਏ ਆ ਧੰਨਵਾਦ